ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਆ ਅੱਛਾ ਹੋਰ ਘਰੇ ਠੀਕ ਠਾਕ ਨੇ ਬੱਚੇ ਅੱਛਾ ਜੀ ਹਾਂਜੀ ਹਾਂਜੀ ਠੀਕ ਨੇ ਜੀ ਹੋਰ ਸੁਣਾਓ

ਸ਼ਹਿਰ 'ਚ ਵਧੀਆ ਜੀ ਵਧੀਆ ਲੱਗ ਗਿਆ ਵਧੀਆ ਲੱਗਿਆ ਜੀ ਸਹੂਲਤਾਂ ਨੇ ਸਾਰੀਆਂ ਪਿੰਡ 'ਚ ਥੋੜ੍ਹਾ ਜਿਹਾ ਔਖੇ ਜਿਹੇ ਸੀਗੇ ਹਾਂਜੀ ਹਾਂਜੀ ਹਾਂ ਹਾਂਜੀ ਹਾਂ ਹੋਰ ਕੀ ਹੁਣ ਸ਼ਹਿਰ 'ਚ ਤਾਂ ਕਿੰਨੀਆਂ ਸਹੂਲਤਾਂ ਨੇ ਕੋਈ ਮਤਲਬ ਕਿ ਡਾਕਟਰ ਵਗੈਰਾ ਸਾਰਾ ਰਾਤ ਬਰਾਤੇ ਕੋਈ ਵੀ ਲੋੜ ਪੈ ਜਾਏ ਹੈ ਨਾ ਮਿੰਟਾਂ ਦੀ ਆਪਾਂ ਜਾ ਸਕਦੇ ਹਾਂ ਪਿੰਡ 'ਚ ਤਾਂ ਫਿਰ ਆਉਣਾ ਔਖਾ ਹੋ ਜਾਂਦਾ ਕੋਈ ਨਹੀਂ ਬਸ ਪਿੰਡਾਂ 'ਚ ਨਹੀਂ ਬੱਸ ਸਰਵਿਸ ਨਹੀਂ ਹੈਗੀ ਟਾਈਮ ਵੇਸਟ ਹੋ ਜਾਂਦਾ ਟਾਈਮ ਵੀ ਲੱਗ ਜਾਂਦਾ ਹਾਂਜੀ ਹਾਂਜੀ ਹਾਂਜੀ ਹਾਂ ਜੀ ਹਾਂ ਉਹ ਟਿਊਸ਼ਨ ਟਾਸ਼ਨ ਦਾ ਪਿੰਡ 'ਚ ਔਖਾ ਹੋ ਜਾਂਦਾ ਸ਼ਹਿਰ 'ਚ ਤਾਂ ਬੱਚੇ ਚਲੋ ਤੁਰ ਕੇ ਵੀ ਚਲੇ ਜਾਂਦੇ ਆ ਉੱਥੇ ਤਾਂ ਫਿਰ ਆਪਾਂ ਨੂੰ ਕੋਈ ਨਾ ਕੋਈ ਵਹੀਕਲ ਵਗੈਰਾ ਵੀ ਚਾਹੀਦਾ ਹੈ ਨਾ ਕਈ ਵਾਰ ਬੱਚਾ ਲੇ ਕਈ ਵਾਰ ਬੱਚਾ ਲੇਟ ਹੋ ਜਾਂਦਾ ਗਾ ਫਿਰ ਟੈਨਸ਼ਨ ਰਹਿੰਦੀ ਸੀ ਹੁਣ ਇੱਥੇ ਪਿੱਛੇ ਆਪਾਂ ਜਾ ਕੇ ਦੇਖ ਸਕਦੇ ਹੈਗੇ ਵੀ ਬੱਚਾ ਕਿਉਂ ਨਹੀਂ ਆਇਆ ਜਾਂ ਐਵੇਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ

ਹੋਰ ਠੀਕ ਆ ਦੀਦੀ ਵਧੀਆ ਜੀ ਸ਼ਹਿਰ 'ਚ ਤਾਂ ਨਾ ਮਤਲਬ ਕਿ ਕੋਈ ਐਵੇਂ ਕੋਈ ਆਪਣਾ ਕੋਈ ਗੈਸਟ ਆ ਜਾਂਦੇ ਨੇ ਕੋਈ ਆਪਾਂ ਨੂੰ ਸੌ ਤਰ੍ਹਾਂ ਦੀ ਚੀਜ਼ ਕੋਈ ਖਾਣ ਪੀਣ ਮੰਗਾਉਣਾ ਹੈਗਾ ਹੈ ਨਾ ਵੀ ਇੱਥੇ ਤਾਂ ਆਪਾਂ ਮਿੰਟ 'ਚ ਲਿਆ ਸਕਦੇ ਹਾਂ ਹਾਂਜੀ ਹਾਂਜੀ ਹਾਂ

ਹਾਂਜੀ ਹਾਂ ਹਾਂ ਵੀ ਸ਼ਹਿਰ ਵਰਗੀ ਤਾਂ ਉਹ ਕਾਹਨੂੰ ਰੀਸ ਹੁੰਦੀ ਆ ਪਿੰਡਾਂ 'ਚ ਹਾਂ ਹਾਂਜੀ ਹਾਂ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਵਧੀਆ ਜੀ ਦੀਦੀ ਹੋਰ ਸਾਰਾ ਪਰਿਵਾਰ ਠੀਕ ਹੈ ਜੀ ਆ ਜਾਇਓ ਇੱਧਰ ਕਦੇ ਗੇੜਾ ਮਾਰ ਜਾਇਓ ਠੀਕ ਹੈ ਜੀ ਠੀਕ ਠੀਕ ਓਕੇ ਜੀ